ਹਾਂਜੀ ਆਪਣੇ ਪੂਜਾ ਸਤਿ ਸ਼੍ਰੀ ਅਕਾਲ ਠੀਕ ਹਾਂ ਵਧੀਆ ਬਸ ਇਸ ਟੈਮ ਤਾਂ ਕਰਕੇ ਬੀਕੋਮ ਵਿਹਲੀ ਫਿਰਦੀ ਹਾਂ ਹੁਣ ਜੋਬ ਬਾਰੇ ਦੇਖਦੀ ਹਾਂ ਕਿੱਥੇ ਲੱਗੀਏ ਅੱਛਾ ਅਤੇ ਐਂਏ ਵਿਹਲਿਆਂ ਦਾ ਤਾਂ ਗੁਜ਼ਾਰਾ ਵੀ ਨਹੀਂ ਹੁੰਦਾ ਦੱਸ ਕਿੱਥੇ ਲੱਗੀ ਲੁੱਗੀ ਕਿਤੇ ਅੜਕੀਏ ਹਾਂ ਨਹੀਂ ਬੈਂਕਾਂ ਦਾ ਇਹ ਹਿਸਾਬ ਹੈ ਨਾ ਬੈਂਕ 'ਚ ਪੇ ਵੀ ਵਧੀਆ ਮਿਲ ਜਾਂਦੀ ਟੀਚਰ ਨੂੰ ਤਾਂ ਪੰਜ ਹਜ਼ਾਰ ਤੋਂ ਉਤਾਂਹ ਨਹੀਂ ਚੜ੍ਹਨਾ ਹੈ ਨਾ ਮੈਨੂੰ ਇੱਥੋਂ ਤੱਕ ਪ੍ਰਾਈਵੇਟ ਤਾਂ ਪੰਜ ਹਜ਼ਾਰ ਹੁੰਦਾ ਇਹਨਾਂ ਦਾ ਜੇ ਹੁਣ ਹਾਂ ਜੇ ਹੁਣ ਵਧੀਆ ਸਕੂਲ 'ਚ ਲੈਂਦੇ ਹਾਂ ਫਿਰ ਇਹ ਵੀ ਚੱਕਰ ਆ ਉੱਥੇ ਰੂਟੀਨ ਨਾਲ ਸਹੀ ਟਾਈਮ 'ਤੇ ਸੱਤ ਵਜੇ ਨਿਕਲਣਾ ਪੈਂਦਾ ਅਤੇ ਨਹੀਂ ਫਿਰ ਜਿਹੜਾ ਬੈਂਕਾਂ ਵਾਲਾ ਕੰਮ ਹੈ ਉਹ ਸਾਢੇ ਨੌ ਵੀ ਪਹੁੰਚ ਜਾਓ ਚੱਲ ਲੋਕਲ ਹੈਗੀਆਂ ਆਪਾਂ ਕਿਹੜਾ ਉਹ ਆ ਹੈ ਨਾ ਮੈਂ ਬੜੀ ਟੈਂਸ਼ ਪ੍ਰਾਈਵੇਟ ਵੀ ਹਾਂ ਹਾਂ ਲੈ ਇਹ ਤਾਂ ਫਿਰ ਜ਼ਿਆਦਾ ਵਧੀਆ ਨਾਲ ਘਰ ਦੇ ਖੁਸ਼ ਹੋ ਜਾਣਗੇ ਹੋਰ ਵੇਲਿਆਂ ਨੂੰ ਪਤਾ ਕੀ ਆ ਵੇਹਲਿਆਂ ਨੂੰ ਔਖਾ ਵੀ ਬਹੁਤ ਆ ਹੁਣ ਪੜ੍ਹ ਲਿਖ ਕੇ ਨਾ ਫਿਰ ਘਰ ਬਹਿਣਾ ਵੀ ਔਖਾ ਹੈ ਨਾ ਅਤੇ ਹਾਂ ਹੋਰ ਅਤੇ ਹੁਣ ਬੈਂਕਾਂ ਅਤੇ ਜਾਂ ਮੈਡੀਕਲ ਵੀ ਆਪਣੇ ਹੈਗਾ ਉਹ ਪਰ ਇਹ ਆ ਕਿ ਹਾਂ ਜੇ ਆਪਾਂ ਅਸੀਂ ਉੱਥੇ ਇਹ ਆ ਕਿ ਪੱਕੇ ਹੋਣ ਦੇ ਚਾਂਸਿਸ ਹੋ ਜਾਂਦੇ ਆ ਮੈਡੀਕਲ ਜਿਹੜਾ ਹੈਗਾ ਹੁੰ ਹੁੰ ਹੁੰ ਹੁੰ ਹੁੰ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਨਹੀਂ ਇਹ ਤਾਂ ਹੈਗਾ ਹੁਣ ਚਲ ਇਹ ਆ ਵੀ ਚੱਲੋ ਮੈਡੀਕਲ ਦੇ ਵਿੱਚ ਵੀ ਆਪਣੀਆਂ ਹੈਗੀਆਂ ਮਤਲਬ ਆਪਣੇ ਜਾਣ ਪਛਾਣ ਇਹਨਾਂ ਦੀ ਹੈਗੀ ਆ ਪਾਪਾ ਮੰਮੀ ਦੀ ਅਤੇ ਇਸ ਕਰਕੇ ਤਾਂ ਬੈਂਕਾਂ ਦੇ ਵਿੱਚ ਸਿਰਫ਼ ਮੇਰੇ ਤਾਏ ਦਾ ਹੀ ਮੁੰਡਾ ਲੱਗਿਆ ਵਾ ਵੀ ਉਹ ਤਾਂ ਕਹੀ ਜਾਂਦਾ ਸੀ ਕਹਿੰਦਾ ਮੈਂ ਤੁਹਾਨੂੰ ਦੁਆ ਦਿੰਦਾ ਮੈਂ ਤੁਹਾਨੂੰ ਦੱਸ ਦਿੰਦਾ ਅਤੇ ਚੱਲੋ ਮੈਂ ਕਿਹਾ ਜਿਹੜੀ ਵੀ ਜਿੱਥੇ ਵੀ ਬੰਦਾ ਅੜਕਿਆ ਜਾਂਦਾ ਹੈ ਨਾ ਜੋਬ 'ਤੇ ਬੈਂਕ ਦੀ ਵੈਸੇ ਵਧੀਆ ਹੈਗੀ ਅਤੇ ਹਾਂ ਜਿਹਦੇ 'ਚ ਇੱਕ ਵਾਰ ਹਾਂ ਜਿੰਨੇ ਤੱਕ ਫਰੀ ਹਾਂ ਉੱਨੇ ਤੱਕ ਤਾਂ ਕਿਤੇ ਨਾ ਕਿਤੇ ਤਾਂ ਅੜਕੀਏ ਯਾਰ ਸਾਡਾ ਕਮਾਉਣਾ ਜ਼ਰੂਰੀ ਆ ਹਾਂ ਹਾਂ ਹੋਰ ਹੁਣ ਬਸ ਤੂੰ ਦੇਖ ਆਪਾਂ ਕਰੀਏ ਭੱਜ ਨੱਠ ਜਿਹੀ ਕੋਈ ਨੌਕਰੀਆਂ ਦੇਖੀਏ ਜਾਂ ਕੋਈ ਸਕੂਲ 'ਚ ਵੈਸੇ ਤਾਂ ਸਕੂਲ 'ਚ ਵੀ ਮਿਲ ਜਾਂਦੀ ਆ ਦੇਖ ਤੂੰ ਦੇਖ ਸਕੂਲ 'ਚ ਵੀ ਮਿਲ ਸਕਦੀ ਹੈ ਮੈਡੀਕਲ 'ਚ ਵੀ ਮਿਲ ਸਕਦੀ ਆ ਅਤੇ ਆਪਾਂ ਨੂੰ ਬੈਂਕਾਂ 'ਚ ਵੀ ਮਿਲ ਸਕਦੀ ਆ ਜਾਂ ਕੋਈ ਜਿਵੇਂ ਹੁਣ ਇਹ ਹੁੰਦੇ ਆ ਮੋਲ ਵਗੈਰਾ ਹੈ ਨਾ ਜੋਬ ਤਾਂ ਇੱਥੇ ਵੀ ਮਿਲ ਹਾਂ ਮੋਲ ਤੇ ਵੀ ਯਾਨੀ ਕਿ ਕੰਪਿਊਟਰ ਵਗੈਰਾ 'ਤੇ ਹੀ ਬਹਿਣਾ ਹੁੰਦਾ ਹੈ ਨਾ ਅਤੇ ਜਿਹੜੇ ਜਿਵੇਂ ਹੁਣ ਇੱਧਰ ਆਪਣੇ ਸ਼ੋਰੂਮ ਹੈ ਸ਼ੋਰੂਮ ਦੇ ਵਿੱਚ ਹੀ ਆਪਾਂ ਨੂੰ ਵੈਸੇ ਅਕਾਊਂਟ ਵਾਲਿਆਂ ਨੂੰ ਮਿਲ ਜਾਂਦਾ ਹੈ ਨਾ ਅਤੇ ਕਿਉਂਕਿ ਹਾਂ ਹਾਂ ਨਹੀਂ ਨਹੀਂ ਸ਼ੋਰੂਮ ਹੈ ਸ਼ੋਰੂਮਾਂ 'ਤੇ ਵੀ ਆਪਾਂ ਯਾਨੀ ਕਿ ਬਿਲ ਕੱਟਣ ਵਾਲਿਆਂ 'ਚ ਵੀ ਲੱਗ ਸਕਦੇ ਹਾਂ ਉਹਦੇ 'ਚ ਵੀ ਬ ਯਾਨੀ ਕਿ ਵਧੀਆ ਹੈਗਾ ਹੈ ਨਾ ਅਤੇ ਮਾਲ 'ਚ ਵੀ ਹੋ ਸਕਦਾ ਵਧੀਆ ਮੌਲ 'ਚ ਵੀ ਹੁਣ ਦੇਖੋ ਬਿਲ ਬੁਲ ਕੱਟਣੇ ਹੁੰਦੇ ਉੱਥੇ ਕੰਪਿਊਟਰ 'ਤੇ ਹੀ ਵਾ ਆਪਾਂ ਨੂੰ ਤਾਂ ਸ਼ੌਂਕ ਹੀ ਨਾਲੇ ਕੰਪਿਊਟਰ ਦਾ ਸੀਗਾ ਹੈ ਨਾ ਹਾਂ ਉਹਦੇ ਕਰਕੇ ਹਾਂ ਠੀਕ ਆ ਚੱਲ ਕੋਈ ਨਹੀਂ ਆਪਾਂ ਕੱਲ੍ਹ ਮਿਲਦੇ ਹਾਂ ਫਿਰ ਆਪਾਂ ਦੇਖਦੇ ਹਾਂ ਹਾਂ ਠੀਕ ਹੈ ਠੀਕ ਠੀਕ ਆ